ਕੀ ਪੁੱਛਣਾ ਹੈਲੋ ਹਾਂਜੀ ਮੈਂ ਕਹਿ ਤਾ ਬੇਟੇ ਪਠਾਨਕੋਟ 'ਚ ਕੋਈ ਚੰਗੀ ਬੇਕਰੀ ਹੈ ਤਾਂ ਸਾਨੂੰ ਦੱਸੋ ਉਸ ਬਾਰੇ

ਹਾਂਜੀ ਅੱਛਾ ਅਤੇ ਜੇ ਇਹਨਾਂ ਕੋਲ ਮੰਗਵਾਉਣਾ ਹੋਇਆ ਤਾਂ ਕਿੰਨੀ ਦੇਰ 'ਚ ਇਹ ਡਿਲੀਵਰ ਕਰਦੇ ਨੇ

ਹਾਂ ਅਤੇ ਕਿੰਨੇ ਮਤਲਬ ਕਿ ਕਿੰਨੇ ਚਾਰਜਿਸ ਪਰ ਕੇਕ ਅਤੇ ਮਤਲਬ ਕਿ ਇੱਕ ਕੇਕ ਦਾ ਕੀ ਪ੍ਰਾਈਜ਼ ਰੱਖਦੇ ਨੇ ਪਰ ਕੇਕ ਦਾ ਹਾਂਜੀ ਅੱਛਾ ਅਤੇ ਹੋਰ ਕੀ ਕੀ ਇਹਨਾਂ ਨੇ ਮਤਲਬ ਕਿ ਰੱਖਿਆ ਵਾ ਉੱਥੇ ਜਿਵੇਂ ਕੋਈ ਸਵੀਟ ਡਿਸ਼ ਵਿੱਚ ਜਾਂ ਕੋਈ ਉਹਨਾਂ ਨੂੰ ਕੋਈ ਮਿਠਾਈ ਵਿੱਚ ਕੋਈ ਚੀਜ਼ ਰੱਖੀ ਵੀ ਇੱਥੇ ਅਤੇ ਦਸ ਮਤਲਬ ਕਿ ਦਸ ਪੰਦਰਾਂ ਤੀਹ ਮਿੰਟ ਦਾ ਵੈਸੇ ਟਾਈਮ ਲੈਂਦੇ ਜਮੈਂਟੋ ਵਾਲੇ ਅਤੇ ਇਹਦੇ ਇੰਨੇ ਵਿੱਚ ਡਿਲੀਵਰ ਕਰ ਦਿੰਦੇ ਨੇ ਘਰ ਠੀਕ ਹੈ ਓਕੇ ਬਾਏ